ਜਿਵੇਂ ਕਿ ਮੈਨੂੰ ਬਚਪਨ ਤੋਂ ਹੀ ਬਹੁਤ ਸ਼ੌਕ ਸੀਗਾ ਟੀਚਰ ਬਣਨ ਦਾ ਅਤੇ ਮੈਂ ਆਪਣੇ ਉਸ ਸ਼ੌਕ ਨੂੰ ਪੂਰਾ ਕੀਤਾ ਮੈਂ ਆਪਣੀ ਪੜ੍ਹਾਈ ਦੇ ਨਾਲ ਨਾਲ ਜੋਬ ਸਟਾਰਟ ਕੀਤੀ ਟੀਚਰ ਦੀ ਮੈਂ ਹੁਣ ਜੋਬ ਕਰ ਰਹੀ ਹਾਂ ਨਾਲ ਨਾਲ ਟੀਚਰ ਦੀ ਇਹਦੇ ਨਾਲ ਮੇਰਾ ਹੁਨਰ ਹੋਰ ਵਿਕਸਿਤ ਹੋਇਆ ਅ ਜਿਵੇਂ ਕਿ ਮੈਂ ਹੁਣ ਸਕੂਲ ਪੜ੍ਹਾਉਂਦੀ ਹਾਂ ਛੋਟੇ ਛੋਟੇ ਬੱਚਿਆਂ ਨਾਲ ਰੋਜ਼ ਐਕਸਪੀਰੀਅੰਸ ਕਰਨ ਨੂੰ ਲਾਈਫ ਨੂੰ ਮਿਲਦਾ ਆ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ ਨਾਲ ਪੜ੍ਹਾਈ ਦਾ ਆ ਨਾਲ ਸਿੱਖੀ ਦਾ ਵੀ ਆ ਰੋਜ਼ ਰੋਜ਼ ਕੁਛ ਨਾ ਕੁਛ ਕਿ ਜਿਵੇਂ ਕਿ ਸਾਨੂੰ ਪਤਾ ਹੀ ਆ ਕਿ ਬੰਦੇ ਦੀ ਸਿੱਖਣ ਦੀ ਉਮਰ ਕਦੇ ਮੁੱਕਦੀ ਨਹੀਂ ਆ ਅਤੇ ਉਹਨੂੰ ਸਾਰੀ ਉਮਰ ਸਿੱਖਣਾ ਹੀ ਚਾਹੀਦਾ ਆ ਅਤੇ ਜਿੰਨਾ ਜਿੰਨੀਆਂ ਸਕਿੱਲਸ ਹੋਣ ਉਨੀਆਂ ਹੀ ਥੋੜ੍ਹੀਆਂ ਬੰਦੇ ਦੀ ਪਰਸਨੈਲਿਟੀ ਨੂੰ ਹੋਰ ਡਿਵੈਲਪ ਕਰਦੀਆਂ ਨੇ ਜਿੰਨੀਆਂ ਜ਼ਿਆਦਾ ਸਕਿੱਲਸ ਹੋਣ ਤੇ ਟੀਚਿੰਗ ਇੱਕ ਇਹੋ ਜਿਹਾ ਪ੍ਰੋਫੈਸ਼ਨ ਹੈ ਕਿ ਜਿਹਦੇ ਵਿੱਚ ਤੁਸੀਂ ਡੇਲੀ ਡੇ ਟੂ ਡੇ ਲਾਈਫ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਆ ਸਾਨੂੰ ਅਤੇ ਇਹ ਇਸੇ ਕਰਕੇ ਮੈਂ ਇਸ ਫੀਲਡ ਨੂੰ ਜੁਆਇਨ ਕੀਤਾ ਅਤੇ ਮੈਨੂੰ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਸ਼ੌਕ ਸੀਗਾ ਟੀਚਿੰਗ ਦਾ ਅਤੇ ਉਹ ਪ੍ਰੋਫੈਸ਼ਨ ਮੈਂ ਆਪਣੀ ਲਾਈਫ 'ਚ ਇੰਪਲੀਮੈਂਟ ਕੀਤਾ ਉਸੀ ਚੀਜ਼ ਨੂੰ ਅਤੇ ਮੈਂ ਮੈਂ ਰੋਜ਼ ਟੀਚ ਕਰਦੀ ਹਾਂ ਕੁਛ ਖੁਦ ਨੂੰ ਵੀ ਸਿੱਖਣ ਨੂੰ ਮਿਲਦਾ ਹੈ ਕੁਛ ਬੱਚਿਆਂ ਨੂੰ ਵੀ ਸਿਖਾਈਦਾ ਆ ਅਤੇ ਮੈਂ ਟਿਊਸ਼ਨ ਵੀ ਸਟਾਰਟ ਕੀਤੀਆਂ ਨੇ ਘਰ ਸ਼ਾਮ ਨੂੰ ਉਹ ਵੀ ਕਰੀ ਦਾ ਹੈ ਟਿਊਸ਼ਨ ਨਾਲ ਨਾਲ ਆਪਣੀ ਪੜ੍ਹਾਈ ਅਤੇ ਇਹਦੇ ਨਾਲ ਮੇਰਾ ਜੋ ਹੁਨਰ ਹੋਰ ਤੋਂ ਹੋਰ ਵਿਕਸਿਤ ਹੋ ਰਿਹਾ ਹੈ